ਹਾਂਜੀ ਵੀਰ ਜੀ ਜਿਹੜਾ ਮੈਂ ਤੁਹਾਡੇ ਕੋਲੋਂ ਐਮਾਜ਼ੋਨ ਤੋਂ ਐਡੂਕਾਟ ਦੀ ਬਾਏਲੋਜੀ ਦੀ ਕਿਤਾਬ ਮੰਗਵਾਈ ਸੀ ਨਾ ਦਸਵੀਂ ਦੇ ਲਈ ਆਈ ਸੀ ਐੱਸ ਈ ਬੱਚਿਆਂ ਦੇ ਲਈ ਉਹ ਮੈਂ ਹੁਣ ਇੱਕ ਅਧਿਆਪਕ ਹਾਂ ਅਤੇ ਮੈਂ ਉਨ੍ਹਾਂ ਕਿਤਾਬਾਂ ਵਿੱਚੋਂ ਦੀ ਇੰਨਾ ਫਾਇਦਾ ਲਿੱਤਾ ਆਪਣੇ ਵਿਦਿਆਰਥੀਆਂ ਨੂੰ ਉਹਨਾਂ ਵਿੱਚੋਂ ਸਾਰੇ ਪ੍ਰਸ਼ਨ ਪੱਤਰ ਮੈਂ ਹੱਲ ਕਰਵਾਏ ਅਤੇ ਜੇੇ ਕਿਤੇ ਉਦੋਂ ਮੈਂ ਨਹੀਂ ਬੱਚਿਆਂ ਕੋਲ ਸੀ ਤਾਂ ਪਤਾ ਸੀ ਤੁਹਨੂੰ ਕੀ ਉਹਦੇ 'ਚ ਹੋ ਰਿਹਾ ਸੀ ਉਹਦੇ 'ਚ ਉਹਨਾਂ ਨੇ ਨਾ ਇੱਕ ਸਾਨੂੰ ਉਹ ਦਿੱਤਾ ਹੈ ਕੋਡ ਉਹ ਕੋਡ ਨੂੰ ਜਦੋਂ ਮੈਂ ਸਕੈਨ ਕਰਦੀ ਸਾਂ ਤਾਂ ਮੈਨੂੰ ਸਾਰੇ ਹੀ ਸਵਾਲਾਂ ਦੇ ਉੱਤਰ ਵੀ ਮਿਲ ਜਾਂਦੇ ਸਨ ਮੈਨੂੰ ਉਹਨਾਂ ਦੀ ਉਹਨਾਂ ਵਾਲੇ ਪ੍ਰਸ਼ਨ ਪੱਤਰਾਂ ਦੀ ਐਨੀ ਕੁ ਮਦਦ ਮਿਲੀ ਕਿ ਮੈਂ ਉਹਨਾਂ ਦੇ ਨਾਲ ਆਪਣੇ ਬੱਚਿਆਂ ਨੂੰ ਇੰਨਾ ਸੋਹਣਾ ਤਿਆਰ ਕਰਵਾਇਆ ਅਤੇ ਜਦੋਂ ਪਿੱਛੇ ਰਿਜਲਟ ਆਇਆ ਨਾ ਮੇਰੇ ਕਿੰਨੇ ਹੀ ਬੱਚਿਆਂ ਦੇ ਸੌ ਵਿੱਚੋਂ ਸੌ ਨੰਬਰ ਆਏ ਅਤੇ ਮੈਂ ਤੁਹਾਨੂੰ ਫਿਰ ਤੋਂ ਕਹਾਵਾਂਗੀ ਕਿ ਉਹ ਕਿਤਾਬਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਦੱਸੋ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਹਰ ਟਾਈਪ ਦੇ ਹਰ ਕਿਸਮ ਦੇ ਪ੍ਰਸ਼ਨ ਦੇ ਬਾਰੇ ਦੱਸਿਆ ਹੈ ਕਿ ਜਿਵੇਂ ਉਹਨਾਂ ਨੇ ਉੱਥੇ ਸਾਰੀਆਂ ਉਹਨਾਂ ਦੀ ਪਰਿਭਾਸ਼ਾ ਦੇ ਕੇ ਪੁੱਛਿਆ ਇਹਦਾ ਨਾਮ ਕੀ ਹੈ ਬਾਕੀਆਂ ਵਿੱਚ ਤਾਂ ਕੁਛ ਹੋਰ ਹੁੰਦਾ ਇਹਨਾਂ ਵਿੱਚ ਉਹਨਾਂ ਨੇ ਉਹੀ ਪੈਟਰਨ ਫੋਲੋ ਕੀਤਾ ਹੈ ਜਿਹੜਾ ਕਿ ਪ੍ਰਸ਼ਨ ਪੱਤਰ ਦਾ ਪੈਟਰਨ ਕਾਊਂਸਿਲ ਆਈ ਸੀ ਐੱਸ ਈ ਕਾਊਂਸਲ ਦਿੰਦੀ ਹੈ ਇੰਝ ਹੀ ਉਹਨਾਂ ਦੇ ਸੀ ਬੀ ਐੱਸ ਈ ਦੀਆਂ ਕਿਤਾਬਾਂ ਵੀ ਆਈਆਂ ਅਤੇ ਮੈਂ ਉਹਨਾਂ ਨੂੰ ਵੇਖਿਆ ਉਹਦੇ ਵਿੱਚ ਵੀ ਉਹਨਾਂ ਨੇ ਪ੍ਰਸ਼ਨ ਪੱਤਰ ਉਂਝ ਹੀ ਦਿੱਤੇ ਨੇ ਬੱਚਿਆਂ ਨੂੰ ਹੱਲ ਕਰਨ ਦੇ ਲਈ ਜਿਹੜੇ ਕਿ ਕਾਊਂਸਿਲ ਜਾਂ ਸੀ ਬੀ ਐੱਸ ਈ ਉਹਨਾਂ ਨੂੰ ਕਹਿੰਦੀ ਹੈ ਕਿ ਫਾਈਨਲ ਪੇਪਰਾਂ ਵਿੱਚ ਆਉਣਗੇ